ਸਾਲਾਂ ਦੌਰਾਨ ਤੈਰਾਕੀ ਪ੍ਰਤੀ ਮੈਂ ਕਾਫੀ ਕੁਛ ਸਿੱਖਿਆ ਹੈ ਕਿਉਂਕਿ ਤੈਰਾਕੀ ਨਾਲ ਸਾਨੂੰ ਕਾਫੀ ਬੈਨੀਫਿਟ ਹੁੰਦੇ ਨੇ ਅਤੇ ਮੈਂ ਸਟਾਰਟਿੰਗ ਤੋਂ ਹੀ ਤੈਰਾਕੀ ਦਾ ਬਹੁਤ ਸ਼ੌਂਕ ਰੱਖਦਾ ਸੀ ਮੈਂ ਅਤੇ ਮੇਰੇ ਕਈ ਦੋਸਤ ਇਕੱਠੇ ਹੋ ਕੇ ਅਸੀਂ ਨਹਿਰ ਵਿੱਚ ਤੈਰਾਕੀ ਕਰਦੇ ਸੀ ਅਤੇ ਤੈਰਾਕ ਸਿੱਖਦੇ ਸੀ ਅਤੇ ਇਸ ਨਾਲ ਸਾਨੂੰ ਬੜਾ ਫਾਇਦਾ ਹੁੰਦਾ ਹੈ ਕਿ ਅਸੀਂ ਕਿਤੇ ਸਟੇਟ ਲੈਵਲ 'ਚ ਵੀ ਜਾ ਕੇ ਤੈਰਾਕੀ ਕਰਕੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਨ ਅਤੇ ਅਸੀਂ ਕੋਈ ਅਗਰ ਪਰਸਨ ਪਾਣੀ 'ਚ ਡੁੱਬ ਰਿਹਾ ਹੈ ਅਤੇ ਜਾਂ ਅਸੀਂ ਸਾਨੂੰ ਤੈਰਾਕੀ ਆਉਂਦੀ ਹੈ ਤਾਂ ਅਸੀਂ ਤੈਰਾਕ ਕਰਕੇ ਉਹਨੂੰ ਬਚਾ ਵੀ ਸਕਦੇ ਹਨ ਜਿਸ ਨਾਲ ਉਸ ਇਨਸਾਨ ਦੀ ਜ਼ਿੰਦਗੀ ਬਚ ਸਕਦੀ ਹੈ ਠੀਕ ਹੈ